ਅੰਮ੍ਰਿਤਸਰ ਵਿੱਚ ਸਿੱਖਿਆ ਜਾਂ ਸਿੱਖਣ ਦੇ ਮੌਕੇ ਬਹੁਤ ਸਾਰੇ ਹਨ ਜਿਵੇਂ ਕਿ ਵੀ ਵੀ ਕੇ ਡੀ ਏ ਵੀ ਕੋਲਜਿਸ ਗਵਰਮੈਂਟ ਕੋਲਜਿਸ ਗੁਰੂ ਰਾਮਦਾਸ ਕੋਲਜ ਮੈਂ ਆਪ ਵੀ ਵੀ ਕੇ ਡੀ ਏ ਵੀ ਕੋਲਜ ਤੋਂ ਪੜ੍ਹੀ ਹੋਈ ਹਾਂ ਅਤੇ ਮੈਨੂੰ ਪਤਾ ਹੈ ਕਿ ਉੱਥੇ ਬਹੁਤ ਵਧੀਆ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਅਤੇ ਹਰ ਇੱਕ ਸੀਖ ਦਿੱਤੀ ਜਾਂਦੀ ਹੈ ਜਿਸ ਨੂੰ ਬੱਚੇ ਆਪਣੀ ਜ਼ਿੰਦਗੀ 'ਚ ਬਹੁਤ ਚੰਗੇ ਤਰੀਕੇ ਨਾਲ ਅਮਲ ਕਰ ਸਕਦੇ ਹਨ ਇੱਕ ਉੱਥੋਂ ਦੀ ਖਾਸੀਅਤ ਹੈ ਕਿ ਉਹ ਸਿਰਫ ਕੁੜੀਆਂ ਦਾ ਕੋਲਜ ਹੈ ਜੇ ਕਿਸੇ ਦੇ ਘਰ ਵਾਲੇ ਨਹੀਂ ਮੰਨਦੇ ਕਿ ਉਹ ਆਪਣੇ ਬੱਚਿਆਂ ਨੂੰ ਕੋਐਡ ਵਿੱਚ ਪੜ੍ਹਾਉਣ ਤਾਂ ਉਹ ਵੀ ਵੀ ਕੇ ਡੀ ਏ ਵੀ ਕੋਲਜ ਵਿੱਚ ਆਪਣੇ ਬੱਚਿਆਂ ਨੂੰ ਭੇਜਦੇ ਹਨ ਕਿਉਂ ਕਿਉਂਕਿ ਉਹ ਚਾਹੁੰਦੇ ਹਨ ਕਿ ਸਿਰਫ ਕੁੜੀਆਂ ਦਾ ਹੀ ਕੋਲਜ ਹੋਵੇ ਅਤੇ ਉੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਉੱਥੇ ਹਰ ਚੀਜ਼ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਸਿਖਾਇਆ ਜਾਂਦਾ ਹੈ ਭਾਵੇਂ ਉਹ ਕੋਈ ਵੀ ਕੰਮ ਹੋਵੇ ਕੋਈ ਵੀ ਕੋਰਸ ਹੋਵੇ ਕੋਈ ਵੀ ਕਲਚਰਲ ਐਕਟੀਵਿਟੀ ਹੋਵੇ ਉਸ ਚੀਜ਼ ਨੂੰ ਬਹੁਤ ਚੰਗੇ ਅਤੇ ਬਾਰੀਕੀ ਨਾਲ ਸਮਝਾਇਆ ਜਾਂਦਾ ਹੈ ਇਹ ਸਭ ਵੇਖ ਕੇ ਵਿਕਾਸ ਵਿੱਚ ਬਹੁਤ ਹੀ ਚੰਗੇ ਤਰੀਕੇ ਨਾਲ ਯੋਗਦਾਨ ਪਾਉਂਦੀਆਂ ਹਨ ਕਿਉਂਕਿ ਜਦੋਂ ਇੱਥੇ ਬੱਚੇ ਪੜ੍ਹ ਕੇ ਅੱਗੇ ਵੱਧਦੇ ਹਨ ਅਤੇ ਉਹਨਾਂ ਨੂੰ ਆਪਣੀ ਲਾਈਫ 'ਚ ਅੱਗੇ ਕੀ ਕਰਨਾ ਹੈ ਉਹਨਾਂ ਨੂੰ ਉਹ ਗੱਲ ਸਮਝ ਆਉਂਦੀ ਹੈ ਅਤੇ ਉਹ ਅੱਗੇ ਵੱਧ ਕੇ ਆਪਣੀ ਚੀਜ਼ ਨੂੰ ਬਹੁਤ ਚੰਗੇ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਲੈ ਕੇ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਸਟਾਰਟਿੰਗ 'ਚ ਹੀ ਇੰਨੀ ਵਧੀਆ ਸਿੱਖਿਆ ਇੱਥੋਂ ਮਿਲੀ ਹੈ ਪੰਜਾਬ ਵਿੱਚ ਜਿਹੜੇ ਸਰਕਾਰੀ ਸਕੂਲ ਹਨ ਉਹਨਾਂ ਵਿੱਚ ਵੀ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੇਰਿਤ ਕੀਤਾ ਜਾਂਦਾ ਹੈ ਆਉਣ ਵਾਲੇ ਸਮੇਂ ਦੇ ਲਈ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹਨਾਂ ਲਈ ਕੀ ਸਹੀ ਹੈ ਅਤੇ ਕੀ ਗਲਤ ਹੈ ਕੁਝ ਬੱਚਿਆਂ ਦਾ ਇੰਟਰਸਟ ਕਿਸੀ ਹੋਰ ਚੀਜ਼ 'ਚ ਹੁੰਦਾ ਹੈ ਅਤੇ ਉਹਨਾਂ ਨੂੰ ਉਸ ਚੀਜ਼ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਜੋ 'ਚ ਜਾਣਾ ਹੈ ਤਾਂ ਉਹ ਕਿਵੇਂ ਜਾ ਸਕਦੇ ਹਨ